ਅਥਲੀਟਾਂ ਨੂੰ ਸਿਖਲਾਈ ਦੇਣ ਲਈ ਸਾਡੇ ਖੇਤਰ ਵਿੱਚ ਇੰਨੇ ਤਾਂ ਨਹੀਂ ਪਰ ਇੱਕ ਦੋ ਖੇਤਰ ਜ਼ਰੂਰ ਹੈ ਜੋ ਮਾਧੋਪੁਰ ਸਟੇਡੀਅਮ ਅਤੇ ਇੱਕ ਇੰਜੀਨੀਅਰਿੰਗ ਕੋਲਜ ਵਿੱਚ ਬੱਚੇ ਜੋ ਐਥਲੀਟ ਹੈਂ ਉਹ ਖੇਡਣ ਜਾਂਦੇ ਹਨ ਰੋਜ਼ ਸ਼ਾਮ ਨੂੰ ਜਾਂ ਰੋਜ਼ ਸਵੇਰੇ ਉਹ ਪੱਕਾ ਜਾਂਦੇ ਹਨ ਅਤੇ ਅਗਰ ਗੱਲ ਕਰੀਏ ਉਹਨਾਂ ਨੂੰ ਸਹੀਲ ਸਹੂਲਤਾਂ ਉਪਲਬਧ ਜੋ ਹਨ ਉਹ ਉਹਨਾਂ ਨੂੰ ਰਿਫਰੈਸ਼ਮੈਂਟ ਵਗੈਰਾ ਪ੍ਰੋਪਰ ਦਿੱਤੀ ਜਾਂਦੀ ਹੈ ਅਤੇ ਉੱਥੇ ਪੂਰਾ ਅਰੇਂਜਮੈਂਟ ਹੁੰਦਾ ਸਾਰੀ ਗੇਮਸ ਦਾ ਸਾਰੀ ਸਪੋਰਟਸ ਦਾ ਅਤੇ ਅਗਰ ਗੱਲ ਕਰੀਏ ਰਾਜ ਦੀ ਹਰ ਰਾਜ ਜ਼ਮੀਨੀ ਪੱਧਰ ਦੀ ਪ੍ਰਤਿਭਾ ਦੀ ਪਹਿਚਾਣ ਕਰਨ ਅਤੇ ਰਾਜ ਵਿੱਚੋਂ ਖੇਡ ਪ੍ਰਤਿਭਾ ਨੂੰ ਇੱਕ ਵੱਡਾ ਪਲੇਟਫੋਮ ਦੇਣ ਲਈ ਸਲਾਨਾ ਖੇਲੋ ਇੰਡੀਆ ਖੇਡਾਂ ਦਾ ਆਯੋਜਨ ਕੀਤਾ ਜਾ ਸਕਦਾ ਹੈ ਜਿਹੜੇ ਰਾਜ ਪਹਿਲਾਂ ਹੀ ਸਲਾਨਾ ਖੇਡ ਮੁਕਾਬਲੇ ਕਰਵਾਉਂਦੇ ਹਨ ਉਹ ਖੇਲੋ ਇੰਡੀਆ ਸਕੀਮ ਨਾਲ ਜੁੜ ਸਕਦੇ ਹਨ ਅਤੇ ਕੇਂਦਰ ਇਹਨਾਂ ਸਮਾਗਮਾਂ 'ਤੇ ਆਯੋਜਨ ਵਿੱਚ ਉਹਨਾਂ ਦਾ ਸਹਿਯੋਗ ਕਰੇਗਾ ਅਤੇ ਮੈਂ ਚਾਹੁੰਦੀ ਹਾਂ ਮੇਰਾ ਖੇਤਰ ਇਸ ਇਹ ਸਕੀਮ ਜ਼ਰੂਰ ਪਾਏਗਾ ਅਤੇ ਤਰੱਕੀਆਂ ਕਰੇਗਾ ਅਗਰ ਗੱਲ ਕਰੀਏ ਓਲੰਪਿਕਸ ਦੀ ਓਲੰਪਿਕ ਦੇ ਲੀਏ ਕਿਸੇ ਅਥਲੀਟ ਨੂੰ ਤਿਆਰ ਹੋਣ ਵਿੱਚ ਘੱਟੋ ਘੱਟ ਅੱਠ ਸਾਲ ਲੱਗਦੇ ਹਨ ਅਤੇ ਜੇ ਅਸੀਂ ਬਾਅਦ ਵਿੱਚ ਕਿਸੇ ਪ੍ਰਤੀਭਾ ਨੂੰ ਪਹਿਚਾਣਦੇ ਹਾਂ ਤਾਂ ਉਹਨਾਂ ਨੂੰ ਓਲੰਪਿਕ ਪੋਡੀਅਮ ਵਿੱਚ ਭੇਜਣ ਦੀ ਸੰਭਾਵਨਾ ਸੀਮਿਤ ਹੁੰਦੀ ਹੈ ਇਸ ਲਈ ਰਾਜਾਂ ਨੂੰ ਨੌਜਵਾਨ ਪ੍ਰਤਿਭਾ ਦੀ ਪਹਿਚਾਣ ਕਰਨ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਅਤੇ ਅਜਿਹਾ ਕਰਨ ਲਈ ਰਾਜ ਜ਼ਿਲ੍ਹਾ ਬਲਾਕ ਅਤੇ ਪੰਚਾਇਤ ਪੱਧਰ 'ਤੇ ਮੁਕਾਬਲਾ ਕਰਵਾਉਣਾ ਬਹੁਤ ਜ਼ਰੂਰੀ ਹੈ ਮੰਤਰੀ ਨੇ ਪਹਿਲੇ ਦੇ ਅਧਾਰ ਤੇ ਰਾਜਾਂ ਨੂੰ ਖੇਲੋ ਇੰਡੀਆ ਉੱਤਮਤਾ ਰਾਜ ਕੇਂਦਰ ਲਈ ਆਪਣੇ ਬੇਹਤਰੀਨ ਖੇਡ ਢਾਂਚੇ ਦੀ ਪਹਿਚਾਣ ਕਰਨ ਦੀ ਲੋੜ 'ਤੇ ਵੀ ਜ਼ੋਰ ਦਿੱਤਾ ਅਸੀਂ ਪਹਿਲਾਂ ਹੀ ਅੱਠ ਰਾਜਾਂ ਦੀ ਪਹਿਚਾਣ ਕਰ ਚੁੱਕੇ ਹਾਂ ਜਿੱਥੇ ਕਿ ਆਈਸਟਿਨ ਸਥਾਪਿਤ ਕੀਤੀ ਜਾਏਗੀ ਖੇਡ ਮੰਡਰਾਲੇ ਨੂੰ ਤੇਰ੍ਹਾਂ ਰਾਜਾਂ ਤੋਂ ਪ੍ਰਸਤਾਵ ਵੀ ਪ੍ਰਾਪਤ ਹੋਏ ਹਨ ਜਿਨ੍ਹਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ